ਸਾਡੇ ਪਿੰਡਾਂ ਵਿੱਚ ਵਿਆਹ ਸਮੇਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਵਿਆਹ ਦੇ ਪੰਜ ਦਿਨ ਪਹਿਲਾਂ ਹੀ ਗੀਤਾਂ ਦੀ ਰਸਮ ਸ਼ੁਰੂ ਕੀਤ ਹੋ ਜਾਂਦਾ ਹੈ ਇਸ ਗੀਤਾਂ ਵਿੱਚ ਤੀਵੀਂਆਂ ਬੋਲੀਆਂ ਪਾਉਂਦੀਆਂ ਨੇ ਅਤੇ ਗਿੱਧੇ ਪਾਉਂਦੇ ਨੇ ਅਤੇ ਆਂਢੀ ਗੁਆਂਢੀ ਤੋਂ ਮੰਜੇ ਬਿਸਤਰੇ ਇਕੱਠੇ ਕਰਕੇ ਵਿਆਹ ਵਾਲੇ ਘਰ ਪਹੁੰਚਾਉਂਦੇ ਨੇ ਵਿਆਹ ਵਾਲੇ ਘਰ ਵਿੱਚ ਬਹੁਤ ਸਾਰੀ ਖ਼ਰੀਦਾਰੀਆਂ ਵੀ ਕੀਤੀਆਂ ਜਾਂਦੀਆ ਨੇ ਵਿਆਹ ਦੇ ਇੱਕ ਦਿਨ ਪਹਿਲਾਂ ਹੀ ਸਭ ਰਿਸ਼ਤੇਦਾਰਾਂ ਅਤੇ ਆਂਢੀ ਗੁਆਂਢੀ ਅਤੇ ਭੋਜਨ ਕਰਾਇਆ ਜਾਂਦਾ ਹੈ ਵਿਆਹ ਵਾਲੇ ਦਿਨ ਬਰਾਤ ਆਉਣ 'ਤੇ ਕੁੜੀ ਵੱਲੋਂ ਮੁੰਡੇ ਦਾ ਸੁਆਗਤ ਕੀਤਾ ਕਰਾਇਆ ਜਾਂਦਾ ਹੈ ਮਿਲਣੀਆਂ ਹੁੰਦੀਆਂ ਹੈ ਕੁੜੀਆਂ ਵੱਲੋਂ ਲਾੜੇ ਤੋਂ ਰੀਬਨ ਕਟਾਉਣ ਕਟਾਉਣ ਦੀ ਅਤੇ ਦੋਵੇ ਇੱਕ ਦੂਜੇ ਨਾਲ ਮਖੌਲ ਕਰਕੇ ਕਰਦੇ ਨੇ ਸਾਲੀਆਂ ਵੱਲੋ ਜੁੱਤੀ ਲਕੋਈ ਰਸਮ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕੁੜੀ ਵੱਲੋਂ ਬਰਾਤੀ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਸ਼ਾਮ ਨੂੰ ਵਾਪਸੀ ਹੋ ਜਾਂਦੇ ਨੇ